ਕਿਵੇਂ ਆਂ ਕਿਰਨ ਵਧੀਆ ਘਰ ਠੀਕ ਨੇ ਸਾਰੇ ਹਾਂ ਹਾਂ ਵਧੀਆ ਮਮੀ ਜੀ ਠੀਕ ਤੁਹਾਡੇ ਅਤੇ ਤੁਹਾ ਪੇਪਰਾਂ ਤੋਂ ਬਾਅਦ ਕੁਝ ਨਹੀਂ ਫਿਲਹਾਲ ਆਪਾਂ ਵਿਹਲੇ ਹਾਂ ਤੁਸੀਂ ਕੀ ਕਰਦੇ ਹੁੰਦੇ ਹੋ ਓਕੇ ਅਤੇ ਤੁਹਾਡੇ ਬ੍ਰਦਰ ਨੇ ਨਾਲੇ ਬਾਹਰ ਜਾਣਾ ਸੀ ਓਕੇ ਅਤੇ ਜਿਹੜੇ ਤੁਹਾਡੇ ਸਿਸਟਰ ਗਏ ਹੋਏ ਸੀਗੇ ਉਹ ਅਤੇ ਤੁਸੀਂ ਫਿਰ ਉੱਧਰ ਦੇਖ ਲੈਣਾ ਸੀ ਉਹਨਾਂ ਕੋਲ ਚਲੇ ਜਾਂਦੇ ਓਕੇ ਜੀ ਠੀਕ ਹੈ ਦੇਖਿਆ ਕਿਸੇ ਪਾਸੇ ਟਰਾਈ ਕੀਤਾ ਜੋਬ ਦਾ ਹਾਂ ਇਹ ਤਾਂ ਹੈ ਵੈਸੇ ਆਪਣੇ ਇੱਥੇ ਜਿਹੜਾ ਘੁੱਦਾ ਕੋਲਜ ਆ ਇਹਦੇ 'ਚ ਪ੍ਰੋਫੈਸਰ ਰੱਖਣੇ ਅਤੇ ਕਲਰਕ ਰੱਖਣੇ ਜੇ ਤੁਹਾਡੇ ਕੋਲ ਹੈਗਾ ਸਮਾਂ ਤੁਸੀਂ ਜਾ ਆਇਓ ਉੱਧਰ ਹਾਂ ਹਾਂ ਮੈਂ ਵੀ ਜਾਣਾ ਮੈਂ ਤੁਹਾਨੂੰ ਨਾਲ ਹੀ ਲੈ ਜਾਊਂਗਾ

ਠੀਕ ਹੈ ਹਾਂ ਆਪਾਂ ਉੱਧਰ ਵੀ ਕਰ ਲਾਂਗੇ ਇੱਕ ਵਾਰੀ ਤਾਂ ਤੁਸੀਂ ਕਲਰਕ 'ਚ ਭਰੋਗੇ ਜਾਂ ਪ੍ਰੋਫੈਸਰੀ 'ਚ ਹਾਂ ਵੈਸੇ ਨੌਕਰੀ ਘੱਟ ਹੀ ਮਿਲਦੀ ਜਿਹੜੇ ਚਾਹ ਵੇ ਲੱਗ ਜਾਣਾ ਚਾਹੀਦਾ ਹਾਂ ਹਾਂ ਇਹ ਤਾਂ ਹੈ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ ਕਿ ਨਹੀਂ ਓਕੇ ਚਲੋ ਮੈਂ ਨਾ ਛੱਬੀ ਤਰੀਕ ਨੂੰ ਫਰੀ ਹਾਂ ਹਾਂ ਹਾਂ ਤੁਸੀਂ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਹੈਗਾ ਨਹੀਂ ਆਪਾਂ ਅਗਾਂਹ ਪਛਾਂਹ ਕੋਈ ਦੇਖ ਲਾਂਗੇ ਟਾਈਮ ਹਾਂ ਹਾਂ ਓਕੇ ਕੋਈ ਗੱਲ ਨਹੀਂ ਓਕੇ ਜੀ